ਹੈਲੋ ਹਾਂਜੀ ਭਾਅ ਜੀ ਤੁਸੀਂ ਸਬਜ਼ੀ ਵਾਲੇ ਬੋਲ ਰਹੇ ਹੋ ਅੱਛਾ ਅਸੀਂ ਰੈਲਮਾਜਰੇ ਤੋਂ ਬੋਲ ਰਹੇ ਆ ਉਹ ਸਰ ਉਹ ਕਿਸੇ ਨੇ ਮੈਨੂੰ ਨਾ ਤੁਹਾਡਾ ਨੰਬਰ ਦਿੱਤਾ ਸੀ ਵੀ ਤੁਸੀਂ ਸਬਜ਼ੀ ਬਹੁਤ ਵਧੀਆ ਦਿੰਦੇ ਹੋ ਅੱਛਾ ਤੁਸੀਂ ਹੌਮ ਤੁਸੀਂ ਹੌਮ ਡਿਲੀਵਰੀ ਕਰਦੇ ਹੋ ਅੱਛਾ ਕੀ ਰੇਟ ਹੈ ਸਬਜ਼ੀਆਂ ਦਾ ਅੱਛਾ ਤੁਹਾਡੇ ਆਪਣੇ ਖੇਤ ਹੈ ਅੱਛਾ ਤੁਸੀਂ ਫਿਰ ਮਤਲਬ ਮੈਂ ਮੇਰੇ ਕੋਲ ਤੁਹਾਡਾ ਨੰਬਰ ਆ ਗਿਆ ਮੈਂ ਨਾ ਤੁਹਾਨੂੰ ਲਿਸਟ ਬਣਾ ਕੇ ਭੇਜ ਦਵਾਂਗੀ ਤੁਸੀਂ ਮਤਲਬ ਹੌਮ ਡਿਲੀਵਰੀ ਕਰਦਿਆ ਕਰੋ ਹੈਂ ਰੋਜ਼ ਚਾਹੇ ਹਫ਼ਤੇ ਦੇ ਵਿੱਚ ਵੀ ਜਦ ਤੁਹਾਡੀ ਦੁਕਾਨ ਕਦ ਤੱਕ ਖੁੱਲ੍ਹੀ ਰਹਿੰਦੀ ਹੈ ਅੱਛਾ ਅੱਛਾ ਅਤੇ ਹੌਮ ਡਿਲੀਵਰੀ ਕਰ ਹੌਮ ਡਿਲੀਵਰੀ ਹੀ ਕਰ ਦਿਓ ਤੁਸੀਂ ਹਨਾ ਅੱਛਾ ਟਾਈਮਿੰਗ ਕੀ ਹੈ ਤੁਹਾਡੀ ਹੌਮ ਡਿਲੀਵਰੀ ਦੀ ਅੱਛਾ ਠੀਕ ਹੈ ਅਤੇ ਹਾਂਜੀ ਲਿਸਟ ਦੇਖ ਕੇ ਤੁਸੀਂ ਮੈਨੂੰ ਡਿਲੀਵਰੀ ਕਰ ਦਿਓ ਹਨਾਂ ਅੱਛਾ ਤੁਸੀਂ ਆਪਣਾ ਮੈਨੂੰ ਵੱਟਸਅੱਪ ਨੰਬਰ ਭੇਜ ਦਿਓ ਠੀਕ ਹੈ ਕੈਸ਼ ਆਨ ਡਿਲੀਵਰੀ ਹੈ ਨਾ ਅੱਛਾ ਅੱਛਾ ਜੀ ਹਾਂਜੀ ਠੀਕ ਹੈ ਜੀ ਓਕੇ ਠੀਕ ਹੈ ਜੀ ਓਕੇ ਠੀਕ ਹੈ ਜੀ ਓਕੇ ਥੈਂਕ ਯੂ